ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਆਰਡਰ ਕੀਤਾ ਸੀ ਮੈਮ ਇੱਕ ਹਾਂਜੀ ਸਾਡਾ ਆਰਡਰ ਹਜੇ ਤੱਕ ਕੁਝ ਪਹੁੰਚਿਆ ਨੀ ਐ ਅ ਹਾਂਜੀ ਅਸੀਂ ਬੇਬੀ ਦੇ ਉਹ ਮੰਗਾਏ ਸੀ ਕਲੋਥਸ ਕੱਪੜੇ ਮੰਗਵਾਏ ਸੀਗੇ ਨਾਲ ਸ਼ੂਜ ਵੀ ਸੀ ਕਾਫੀ ਟਾਈਮ ਹੋ ਗਿਆ ਸਾਨੂੰ ਬਹੁਤ ਜਰੂਰਤ ਸੀ ਸਾਡੀ ਡਿਲੀਵਰੀ ਅੱਜ ਹੋਣੀ ਸੀਗੀ ਡਿਲੇਅ ਹੋ ਗਈ ਜੀ ਪਹਿਲਾਂ ਵੀ ਇਦਾਂ ਹੋਇਆ ਮੈਮ ਤੁਹਾਡੇ ਡਿਲੀਵਰੀ ਲੇਟ ਹੋ ਜਾਂਦੀ ਆ ਹਰ ਵਾਰ ਆਰਡਰ ਕਰਦੇ ਆਂ ਕਦੋਂ ਤੱਕ ਆ ਜਾਏਗਾ ਵੰਨ ਵੀਕ ਤਾਂ ਬਹੁਤ ਜਿਆਦਾ ਮੈਮ ਤੁਹਾਨੂੰ ਜਿੰਨਾ ਜਲਦੀ ਹੋ ਸਕੇ ਤੁਸੀਂ ਕਦੋਂ ਤੱਕ ਪਹੁੰਚਾ ਸਕਦੇ ਹੋ ਕਿੱਥੋਂ ਤੱਕ ਪਹੁੰਚਿਆ ਮਤਲਬ ਕਿੰਨੇ ਕ ਉਹਤੋਂ ਪੈਕਿੰਗ ਵਗੈਰਾ ਹੋ ਗਈ ਅਗਰ ਕਿੱਥੇ ਆ ਗਿਆ ਸਾਡਾ ਆਰਡਰ ਤਿੰਨ ਚਾਰ ਦਿਨ ਵੀ ਬਹੁਤ ਹੋ ਜਾਂਦੇ ਆ ਮੈਮ ਪਰ ਡਿਲੇਅ ਹੋ ਗਿਆ ਨਾ ਬਹੁਤ ਜਿਵੇਂ ਹੁਣ ਜਰੂਰ ਸੀ ਤੇ ਸਮਾਨ ਸਾਡਾ ਹਜੇ ਤੱਕ ਨਹੀਂ ਪਹੁੰਚਿਆ ਟ੍ਰਾਂਸਪੋਰਟ ਹਨਾ ਤੁਹਾਨੂੰ ਟ੍ਰਾਂਸਪੋਰਟ ਡਿਪਾਰਟਮੈਂਟ ਉਹਨਾਂ ਨੂੰ ਮਤਲਬ ਕਹਿਣਾ ਚਾਹੀਦਾ ਕਿ ਸਾਨੂੰ ਵਧੀਆ ਉਹ ਕਰੋ ਵੀ ਅਸੀਂ ਟਾਈਮ ਸਿਰ ਸਾਡੀ ਡਿਲੀਵਰੀ ਦੇ ਸਕੀਏ ਇਸ ਕਰਕੇ ਕਸਟਮਰ ਨੂੰ ਤਾਂ ਬਹੁਤ ਪ੍ਰੋਬਲਮ ਆਉਂਦੀ ਹੈ ਨਾ ਨਹੀਂ ਆਹੀ ਸੀ ਆਰਡਰ ਤਾਂ ਤੇ ਜੀ ਵਧੀਆ ਟਾਈਮ ਮਤਲਬ ਟਾਈਮ ਤੇ ਪਹੁੰਚੇਗਾ ਫਿਰ ਹੀ ਹਨਾ ਨੈਕਸਟ ਟਾਈਮ ਅਸੀਂ ਆਰਡਰ ਕਰਦੇ ਆਂ ਇਦਾਂ

ਹਾਂਜੀ ਕੋਸ਼ਿਸ਼ ਕਰਿਓ ਨਾ ਸਾਡਾ ਆਰਡਰ ਪਹਿਲਾਂ ਪਹੁੰਚ ਜੇ ਨਹੀਂ ਫਿਰ ਅਸੀਂ ਆਰਡਰ ਕੈਂਸਲ਼ ਕਰਨਾ ਪਏਗਾ ਓਕੇ ਇਨਾ ਆਨਲਾਈਨ ਜਿਹੜਾ ਆਰਡਰ ਕਰਦੇ ਆ ਬਹੁਤ ਪ੍ਰੋਬਲਮ ਆਉਂਦੀਆਂ ਨੇ ਜਦੋਂ ਪਾਰਸਲ ਲੇਟ ਹੋ ਜਾਂਦੇ ਨੇ ਤਾਂ ਕੀ ਪਹੁੰਚਦੇ ਨੀ ਟਾਈਮ ਤੇ ਆਹੀ ਨਾ ਪਰਨੀ ਜੋ ਵੀ ਪਾਰਸਲ ਲੇਟ ਹੁੰਦਾ ਰੀਜਨ ਨਹੀਂ ਫਿਰ ਅਸੀਂ ਕੰਪਲੇਂਟ ਕਰ ਸਕਦੇ ਸਾਡਾ ਨਹੀਂ ਹੋਇਆ ਜਾ ਕੈਂਸਲ ਕਰਦੇ ਆ ਕੋਈ ਹਨਾ ਇੱਕ ਕੋਈ ਅਲੱਗ ਰਸਤਾ ਲੱਭੋ ਕਿ ਆਪਾਂ ਕਿਵੇਂ ਇਸ ਚੀਜ਼ ਨੂੰ ਟਾਈਮ ਤੇ ਪਹੁੰਚਾਉਣਾ ਹਾਂਜੀ ਠੀਕ ਹੈ ਜੀ ਓਕੇ ਓਕੇ